ਹੈਲੋ ਕਿਸਾਨ ਭਰਾ ਬੋਲਦੇ ਹੋ ਜੀ ਹਾਂ ਮੈਂ ਤੁਹਾਡਾ ਨਾਂ ਸੁਣਿਆ ਸੀ ਅਤੇ ਤੁਹਾਡੇ ਕਾਰੋਬਾਰ ਵਿੱਚ ਤੁਸੀਂ ਇੱਕ ਬਹੁਤ ਵਧੀਆ ਕਿਸਾਨ ਹੋ ਅਤੇ ਮੈਂ ਥੋਤੋਂ ਜਾਣਕਾਰੀ ਲੈਣਾ ਚਾਹੁੰਦਾ ਕਿਉਂਕਿ ਅਸੀਂ ਇੱਕ ਘਰ ਛੋਟੀ ਜਿਹੀ ਛੋਟੇ ਜਿਹੇ ਪਲਾਟ ਜਿਹਾ ਲਾਇਆ ਬਿਸਵਾ ਪਲਾਟ ਬਣਾਇਆ ਜਿਹਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਕੁਛ ਨਾ ਕੁਛ ਗਰਮੀ ਦੇ ਵਿੱਚ ਉਹਦੇ ਵਿੱਚ ਲਾ ਲਈਏ ਤਾਂ ਕਿ ਸਾਨੂੰ ਮਾੜਾ ਮੋਟਾ ਫਾਇਦਾ ਹੋਵੇ ਨਾਲ ਵਧੀਆ ਲੱਗੇ ਇਸ ਕਰਕੇ ਮੈਂ ਚਾਹੁੰਦਾ ਬਈ ਮੈਨੂੰ ਜਿਹੜੀਆਂ ਮੇਨ ਫਸਲਾਂ ਨੇ ਉਹਨਾਂ ਬਾਰੇ ਕੁਝ ਜਾਣਕਾਰੀ ਦਿਓ ਇਹਨਾਂ 'ਚੋਂ ਫਾਇਦਾ ਕਿਹਦਾ ਵਧੀਆ ਅਤੇ ਸਬਜ਼ੀਆਂ ਬਾਰੇ ਵੀ ਥੋੜ੍ਹਾ ਜਿਹਾ ਚਾਨਣ ਪਾਓ ਵੀ ਸਬਜ਼ੀਆਂ ਕਿਹੜੀਆਂ ਕਿਹੜੀਆਂ ਲਾਈਏ ਕਿਹੜੀਆਂ ਵਧੀਆ ਰਹਿਣਗੀਆਂ ਕੋਈ ਇਹੋ ਜਿਹੀ ਸਬਜ਼ੀ ਹੈ ਜਿਹਦੇ ਵਿੱਚ ਸਾਡੀ ਕਾਸ਼ਤਕਾਰੀ 'ਚ ਸਸਤੀ ਪਵੇ ਉਹਦੇ ਜ਼ਿਆਦਾ ਰੇਹ ਵਗੈਰਾ ਜਾਂ ਸਪਰੇਹਾਂ ਵਗੈਰਾ ਨਾ ਕਰਨੇ ਪੈਣ ਜਾਂ ਸਾਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ ਜਿਹਦਾ ਵਧੀਆ ਘਰੇਲੂ ਫਾਇਦਾ ਸਾਨੂੰ ਹੋਵੇ ਕੋਈ ਇਹੋ ਜਿਹੀ ਸਬਜ਼ੀ ਵੀ ਦੱਸੋ ਠੀਕ ਹੈ ਜੀ ਧੰਨਵਾਦ